ਹੈਲੋ ਅਸੀਂ ਖਾਣਾ ਪਕਾਉਣ ਵਿੱਚ ਵਿੱਚ ਜ਼ਿਆਦਾਤਰ ਜੀਰਾ ਮੇਥੀ ਧਨੀਆ ਆਦਿ ਜੜੀ ਬੂਟੀਆਂ ਦੀ ਵਰਤੋਂ ਕਰਦੇ ਹਾਂ ਇਨ੍ਹਾਂ ਜੜੀ ਬੂਟੀਆਂ ਨੂੰ ਉਗਾਉਣ ਨਾਲ ਉਗਾਉਣ ਉਗਾਉਣ ਨਾਲ ਖਾਣੇ ਦਾ ਸੁਆਦ ਦਾ ਟੇਸਟ ਬੜਾ ਵਧੀਆ ਬਣਦਾ ਹੈ ਅਤੇ ਨਾਲੇ ਅਸੀਂ ਚਾਹ ਵਿੱਚ 'ਚ ਜਮੈਣ ਦੇ ਪੱਤੇ ਵੀ ਪਾ ਸਕਦੇ ਹਾਂ ਜਮੈਣ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਗੁਣਕਾਰੀ ਹੈ ਜਮੈਣ ਨਾਲ ਸਾਡੀ ਸਿਹਤ ਪੇਟ ਦੇ ਕਈ ਰੋਗ ਦੂਰ ਹੁੰਦੇ ਹਨ ਅਤੇ ਹੋਰ ਵੀ ਇਨ੍ਹਾਂ ਚੀਜ਼ਾਂ ਦੇ ਬਹੁਤ ਜ਼ਿਆਦਾ ਫਾਇਦੇ ਹਨ ਸਾਨੂੰ ਇਨ੍ਹਾਂ ਜੜੀ ਬੂਟੀਆਂ ਨੂੰ ਉਗਾਉਣਾ ਚਾਹੀਦਾ ਹੈ ਅਤੇ ਇਨ੍ਹਾਂ ਨੂੰ ਹਮੇਸ਼ਾ ਹੀ ਆਪਣੇ ਖਾਣੇ ਵਿੱਚ ਵਰਤਣਾ ਚਾਹੀਦਾ ਮੇਥੀ ਖਾਣੇ ਦਾ ਟੇਸਟ ਵਧਾਉਂਦੀ ਹੈ ਹਰਾ ਧਨੀਆ ਖਾਣੇ ਦੀ ਸਮੈਲ ਖਬਸ਼ ਖੁਸ਼ਬੂ ਵਧਾਉਂਦਾ ਹੈ ਹਰਾ ਧਨੀਆ ਵੈਸੇ ਪੇਟ ਲਈ ਚੰਗਾ ਵੀ ਹੁੰਦਾ ਹੈ ਅਤੇ ਨਾਲੇ ਇਹ ਠੰਢਾ ਵੀ ਮੰਨਿਆ ਜਾਂਦਾ ਹੈ ਇਸ ਨੂੰ ਖਾਣ ਨਾਲ ਸਰੀਰ 'ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਰੋਗਾਂ ਤੋਂ ਦੁਰ ਮੁਕਤੀ ਮਿਲਦੀ ਹੈ ਅਤੇ ਸਾਨੂੰ ਇਨ੍ਹਾਂ ਜੜੀ ਬੂਟੀਆਂ ਨਾਲ ਹਮੇਸ਼ਾ ਹੀ ਲਗਾਵ ਰੱਖਣਾ ਚਾਹੀਦਾ ਹੈ ਇਹ ਜੜੀ ਬੂਟੀਆਂ ਹਮੇਸ਼ਾ ਉਗਾਉਣੀਆਂ ਚਾਹੀਦੀਆਂ